ਹੈਲੋ ਹਾਂਜੀ ਫਾਜ਼ਿਲਕਾ ਬਹੁਤ ਵਧੀਆ ਸ਼ਹਿਰ ਬਣਿਆ ਹੋਇਆ ਅਤੇ ਬਹੁਤ ਹੀ ਸਾਫ ਏਰੀਆ ਪਾਰਕ ਬਹੁਤ ਵਧੀਆ ਹੀ ਬਣੇ ਹੋਏ ਹੈ ਤੁਸੀਂ ਘੁੰਮਣਾ ਚਾਹੋ ਤਾਂ ਇੱਥੇ ਧਾਰਮਿਕ ਸਥਾਨ ਵੀ ਬਹੁਤ ਅੱਛੇ ਹੈ ਇੱਥੇ ਮੰਦਰ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣੇ ਹੋਏ ਹੈ ਦੇਖਣ ਵਾਲੇ ਹੈ ਸਪੈਸ਼ਲ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਤੁਹਾਨੂੰ ਕਾਰ ਦੁਆਰਾ ਲੈ ਕੇ ਜਾਵਾਂਗੇ ਕਰਾਇਆ ਵੀ ਬਹੁਤ ਘੱਟ ਲੱਗੇਗਾ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਆਏਗੀ ਤੁਹਾਨੂੰ ਹਾਂਜੀ ਘੱਟ ਤੋਂ ਘੱਟ ਲੱਗਣਗੇ ਬਾਹਰ ਨਾਲੋਂ ਘੱਟ ਹੀ ਲੱਗਣਗੇ ਹਜ਼ਾਰ ਰੁਪਏ ਤੱਕ ਲੱਗ ਜਾਏਗਾ ਹਾਂਜੀ ਇੱਥੇ ਨਹਿਰੂ ਪਾਰਕ ਹੈ ਰੋਡ ਵੰਸ਼ ਪਾਰਕ ਹੈ ਹਾਂਜੀ ਤੁਸੀਂ ਆਓਗੇ ਤੁਸੀਂ ਆਓ ਆਪਾਂ ਮਿਲਦੇ ਹੈ ਜ਼ਰੂਰ ਚੰਗੀ ਤਰ੍ਹਾਂ ਘੁਮਾਵਾਂਗੇ ਬਹੁਤ ਅੱਛਾ ਏਰੀਆ ਸਾਫ ਸੁਥਰਾ ਏਰੀਆ ਕੋਈ ਦਿੱਕਤ ਨਹੀਂ ਆਏਗੀ ਹਾਂਜੀ ਹਾਂਜੀ ਫਾਜ਼ਿਲਕਾ 'ਚ ਬਾਰਡਰ ਬਹੁਤ ਵਧੀਆ ਬਣਿਆ ਹੋਇਆ ਸਾਫ ਏਰੀਆ ਔਰ ਨੇੜੇ ਹੈ ਕੋਈ ਖਾਸ ਦੂਰ ਨਹੀਂ ਹੈਗਾ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਜਾਣ 'ਚ ਠੀਕ ਹੈ ਜੀ ਮੈਂ ਅੱਜ ਹੀ ਕਰਦੀ ਐਂ ਅਤੇ ਰੈਂਟ ਵੀ ਠੀਕ ਲੱਗੇਗਾ